ਮੈਂ ਰੋਜ਼ਾਨਾ ਗੁਟਕਾ ਸਾਹਿਬ ਨਿਤਨੇਮ ਦੇ ਵਿੱਚੋਂ ਮੂਲ ਮੰਤਰ ਸਾਹਿਬ ਦਾ ਪਾਠ ਰੋਜ਼ਾਨਾ ਕਈ ਵਾਰ ਕਰਨਾ ਵਾ ਜਿਹਦੀ ਕੋਈ ਗਿਣਤੀ ਨਹੀਂ ਜਿਸ ਤਰਾਂ ਕਿ ਇਕ ਓਂਕਾਰ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ ਆਦਿ ਸਚੁ ਜੁਗਾਦਿ ਸਚੁ ਹੈ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਹਦੇ ਨਾਲ ਸਾਨੂੰ ਗੁਰੂ ਪਾਤਸ਼ਾਹ ਨੇ ਗੁਰੂ ਨਾਨਕ ਦੇਵ ਜੀ ਨੇ ਸਿੱਖਿਆ ਦਿੱਤੀ ਇਹਦੇ ਵਿੱਚ ਕਿਸੇ ਨਾਲ ਮੋਹ ਹੰਕਾਰ ਜਾਂ ਕਿਸੇ ਦਾ ਕੋਈ ਗਲਤ ਕੰਮ ਨਹੀਂ ਕਰਨਾ ਆਪਣੇ ਕਿਰਤ ਕਮਾਈ ਕਰਨੀ ਹੈ ਅਤੇ ਕਿਸੇ ਦਾ ਭੈ ਨਹੀਂ ਮੰਨਣਾ ਮਹਾਰਾਜ ਨੇ ਇਸ ਮੂਲ ਮੰਤਰ ਦੇ ਵਿੱਚ ਸਭ ਕੁਝ ਦਿੱਤਾ ਹੈ ਜੋ ਰਾਗੀ ਪਾਠ ਕਰਦੇ ਨਾਲ ਮੂਲ ਮੰਤਰ ਸਾਹਿਬ ਦੇ ਸਾਨੂੰ ਸਭ ਕੁਛ ਸ੍ਰਿਸ਼ਟੀ ਹੋ ਜਾਂਦੀ ਹੈ ਜਿਹਦੇ ਨਾਲ ਸਾਨੂੰ ਹਰ ਵਕਤ ਸੁਖ ਸ਼ਾਂਤੀ ਮਿਲਦੀ ਹੈ